ਕੋਵਿਡ ਲੌਕਡਾਊਨ ਦੌਰਾਨ ਮੋਬਾਈਲ ਫੋਨ ਨੇ ਬੱਚਿਆਂ ਦੀ ਪੜ੍ਹਾਈ ਵਿੱਚ ਬਹੁਤ ਮਦਦ ਕੀਤੀ ਪਰ ਇਸ ਪੜ੍ਹਾਈ ਦੇ ਨਾਲ ਕੁੱਛ ਫ਼ਾਇਦੇ ਵੀ ਹੋਏ ਔਰ ਕੁਛ ਨੁਕਸਾਨ ਵੀ ਹੋਏ ਪਰ ਹਰ ਚੀਜ਼ ਦੇ ਕੁਛ ਨਾ ਕੁਛ ਫ਼ਾਇਦੇ ਅਤੇ ਕੁਛ ਨਾ ਕੁਛ ਨੁਕਸਾਨ ਜ਼ਰੂਰ ਹੁੰਦੇ ਹਨ ਉਵੇਂ ਹੀ ਮੋਬਾਈਲ ਫੋਨ ਦੇ ਵੀ ਬਹੁਤ ਫ਼ਾਇਦੇ ਵੀ ਗਿਣੇ ਗਏ ਹਨ ਅਤੇ ਨੁਕਸਾਨ ਵੀ ਗਿਣੇ ਹਨ ਪਰ ਕੋਵਿਡ ਲੌਕਡਾਊਨ ਦੌਰਾਨ ਬੱਚੇ ਜਿਵੇਂ ਘਰ ਸਨ ਉਨਾਂ ਨੇ ਪੜ੍ਹਾਈ ਦੇ ਵਿੱਚ ਬਹੁਤ ਮਦਦ ਕੀਤੀ ਲੋ ਬੱਚਿਆਂ ਨੂੰ ਕਲਾਸ ਦੀ ਅਟੈਂਡੈਂਸ ਵੀ ਜ਼ਰੂਰੀ ਕਰ ਦਿੱਤੀ ਸੀ ਜਿਸ ਕਾਰਨ ਬੱਚੇ ਜ਼ੂਮ ਤੋਂ ਕਲਾਸਾਂ ਲਾ ਕੇ ਆਪਣੀ ਪੜ੍ਹਾਈ ਦਾ ਨੁਕਸਾਨ ਹੋਣ ਤੋਂ ਬਚ ਗਏ ਜਿਸ ਕਾਰਨ ਉਨ੍ਹਾਂ ਨੇ ਆਪਣੀ ਪੜ੍ਹਾਈ ਦਾ ਨੁਕਸਾਨ ਨਹੀਂ ਕੀਤਾ ਅਤੇ ਆਪਣੀ ਪੜ੍ਹਾਈ ਨੂੰ ਸਮੇਂ ਸਿਰ ਪੂਰਾ ਵੀ ਕਰ ਲਿਆ ਜਿਸ ਕਾਰਨ ਉਹ ਆਪਣੇ ਅਗਲੀ ਮਿਲੀ ਅਗਲੀ ਜਮਾਤ ਵਿੱਚ ਦਾਖਲ ਹੋਣ ਵਿੱਚ ਮਦਦ ਵੀ ਮਿਲੀ ਪੜ੍ਹਾਈ ਵਿੱਚ ਉਹਨਾਂ ਨੇ ਬਹੁਤ ਕੁਛ ਸਿੱਖਣ ਵੀ ਵਿੱਚ ਵੀ ਬਹੁਤ ਮਦਦ ਮਿਲੀ ਬੱਚਿਆਂ ਨੇ ਇਸ ਚੀਜ ਦੇ ਨਾਲ ਕਈ ਬੱਚੇ ਤਾਂ ਬਹੁਤ ਧਿਆਨ ਨਾਲ਼ ਪੜ੍ਹਦੇ ਸਨ ਪਰ ਇਸ 'ਚ ਕੋਈ ਨੁਕਸਾਨ ਵੀ ਹੋਏ ਪਰ ਇਸ ਦਾ ਨੁਕਸਾਨ ਇਹ ਹੋਇਆ ਕਿ ਬੱਚੇ ਹਰ ਸਮੇਂ ਇਹ ਲੱਗਦਾ ਸੀ ਕਿ ਜਿਵੇਂ ਪੜ੍ਹ ਰਹੇ ਹੁੰਦੇ ਹਨ ਪਰ ਕੁੱਝ ਬੱਚੇ ਇਸ ਦਾ ਨਾਜਾਇਜ਼ ਫ਼ਾਇਦਾ ਵੀ ਚੁੱਕਦੇ ਸਨ ਇਸ ਕਾਰਨ ਉਹ ਹਰ ਸਮੇਂ ਆਪਣੇ ਫੋਨ ਦੇ ਨਾਲ ਫੜ ਕੇ ਬੈਠੇ ਰਹਿੰਦੇ ਸਨ ਜਿਵੇਂ ਫਿਰ ਮਾਂ ਪਿਓ ਨੂੰ ਲੱਗਦਾ ਸੀ ਕਿ ਸਾਡਾ ਬੱਚਾ ਪੜ੍ਹ ਰਿਹਾ ਹੈ ਪਰ ਉਹ ਹਰ ਸਮੇਂ ਪੜ੍ਹਦੇ ਜਾਂ ਕੰਮ ਕਰਦੇ ਨਹੀਂ ਹੁੰਦੇ ਸਨ ਜਿਸ ਕਾਰਨ ਉਨਾਂ ਨੂੰ ਇਸ ਮੋਬਾਈਲ ਫੋਨ ਦੀ ਆਦਤ ਹੀ ਬਣ ਗਈ ਜੀ ਪਰ ਉਹ ਹੁਣ ਕੋਵਿਡ ਤੋਂ ਬਾਅਦ ਵੀ ਇਸ ਫੋਨ ਨੂੰ ਛੱਡਣ ਵਿੱਚ ਨਹੀਂ ਛੱ ਛੱਡਦੇ ਹਨ ਉਹ ਹਰ ਸਮੇਂ ਇਸ ਫੋਨ ਦੇ ਨਾਲ ਹੀ ਚਿਪਕੇ ਰਹਿੰਦੇ ਹਨ ਇਸ ਨਾਲ ਸਿਹਤ ਦਾ ਵੀ ਬਹੁਤ ਨੁਕਸਾਨ ਹੋਇਆ ਅੱਖਾਂ ਦਾ ਵੀ ਬਹੁਤ ਨੁਕਸਾਨ ਹੋਇਆ ਜਿਸ ਕਾਰਨ ਕਈ ਬੱਚਿਆਂ ਨੂੰ ਤਾਂ ਐਨਕਾਂ ਵੀ ਇਸ ਕਾਰਨ ਲੱਗ ਗਈਆਂ ਅਤੇ ਦਿਮਾਗੀ ਵੀ ਬਹੁਤ ਨੁਕਸਾਨ ਹੋਇਆ ਕਈ ਬੱਚਿਆਂ ਦੀ ਸਿਹਤ ਵੀ ਬਹੁਤ ਖ਼ਰਾਬ ਹੋ ਗਈ ਕਈ ਬ ਬੱਚੇ ਇਸ ਦੇ ਕਾਰਨ ਮੋਬਾਈਲ ਦੇ ਸਾਹਮਣੇ ਲੈ ਕੇ ਬੈਠ ਕੇ ਖਾਂਦੇ ਪੀਂਦੇ ਰਹਿੰਦੇ ਸਨ ਜਿਸ ਕਾਰਨ ਉਨ੍ਹਾਂ ਦੀ ਸਿਹਤ ਵਿੱਚ ਵੀ ਬਹੁਤ ਨੁਕਸਾਨ ਹੋਇਆ ਔਰ ਕੋਵਿਡ ਨੇ ਤਾਂ ਬਹੁਤ ਹੀ ਕੰਮ ਖ਼ਰਾਬ ਕਰ ਦਿੱਤਾ ਸੀ